ਹਾਂਜੀ ਅਸੀਂ ਆਂਢ ਗਵਾਂਢ ਦੇ ਘਰਾਂ ਬਾਰੇ ਜਾਣਦੇ ਹਾਂ ਜਿਵੇਂ ਕਿ ਸਾਡੇ ਗੁਰਦੁਆਰੇ ਦੇ ਸਾਹਮਣੇ ਇੱਕ ਧਰਮਸ਼ਾਲਾ ਦੇ ਤੌਰ 'ਤੇ ਇੱਕ ਹੋਟਲ ਬਣਾਇਆ ਗਿਆ ਹੈ ਜਿਸ ਜਿਸ ਲਈ ਜਿਸ ਲਈ ਸੈ ਸੈਲਾਨੀ ਵਾਸਤੇ ਅਸੀਂ ਕੋਈ ਆਈ ਡੀ ਪਰੂਫ ਲੈ ਸਕਦੇ ਹਾਂ ਉ ਉਸ ਦੇ ਆਧਾਰ 'ਤੇ ਅਸੀਂ ਉਸ ਨੂੁੰ ਰਹਿਣ ਵਾਸਤੇ ਇੱਕ ਦਿਨ ਜਾਂ ਦੋ ਦਿਨ ਵਾਸਤੇ ਜਿੰਨੇ ਦਿਨ ਉਹ ਕਹਿੰਦਾ ਹੈ ਰਹਿ ਸਕਦਾ ਹੈ ਫ੍ਰੀ ਸੇਵਾ ਕੀਤੀ ਜਾਂਦੀ ਹੈ ਬਾਕੀ ਇੱਕ ਧਰਮਸ਼ਾਲਾ ਵੀ ਹੈ ਉੱਥੇ ਵੀ ਅਸੀਂ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਹੈ